ਜਿਵੇਂ ਕਿ ਆਪਾਂ ਦੇਖ ਹੀ ਸਕਦੇ ਆ ਵੀ ਹਰੇਕ ਕਲਚਰ ਹਰੇਕ ਸੱਭਿਆਚਾਰ ਦਾ ਆਪਦਾ ਆਪਦਾ ਤਾਰਾ ਮੰਡਲ ਹੁੰਦਾ ਹੈਗਾ ਠੀਕ ਹੈ ਐਂਡ ਇਹ ਜਿਹੜਾ ਤਾਰਾ ਮੰਡਲ ਹੁੰਦਾ ਹੈਗਾ ਇਹ ਜਿਹੜੇ ਸੱਭਿਆਚਾਰ ਦੇ ਵਿੱਚ ਰਹਿੰਦੇ ਹੈਗੇ ਲੋਕ ਉਹ ਉਹਨਾਂ ਦੀ ਸੋਚ ਤੇ ਵੀ ਡਿਪੈਂਡ ਕਰਦਾ ਉਹਨਾਂ ਦੀ ਰਹਿਣੀ ਸਹਿਣੀ ਇਹਨਾਂ ਸਾਰਿਆਂ ਤੇ ਹੀ ਡਿਪੈਂਡ ਕਰਦਾ ਹੈਗਾ ਜਿਵੇਂ ਆਪਾਂ ਵੇਖ ਹੀ ਸਕਦੇ ਆ ਵੀ ਜੋ ਅੰਗਰੇਜ਼ ਸੀ ਉਹਨਾਂ ਨੇ ਕੀ ਆ ਪਹਿਲੀ ਵਾਰੀ ਹੱਲ ਨੂੰ ਵੇਖ ਕੇ ਆ ਠੀਕ ਐਂਡ ਜੋ ਗਰੀਕ ਸੀਗੇ ਉਹਨਾਂ ਨੇ ਕੀ ਹੈਗਾ ਉਹਨੂੰ ਐਜ ਪੋਲਰ ਬੀਅਰ ਐਸ ਆ ਰਿਛ ਵੇਖਿਆ ਸੀਗਾ ਤਾਰਾ ਮੰਡਲ ਨੂੰ ਠੀਕ ਆ ਉਹਨਾਂ ਦੇ ਵਿੱਚੋਂ ਇੱਕ ਓਰੀਅਨ ਇਹੋ ਜਿਹਾ ਤਾਰਾ ਮੰਡਲ ਹੈ ਜਿਹਨੂੰ ਕਿ ਚੀਨੀ ਅਰੇਬੀਅਨਸ ਐਂਡ ਗਰੀਟਸ ਹੈਗੇ ਆ ਉਹਨਾਂ ਨੇ ਦੇਖਿਆ ਐਂਡ ਆਪਾਂ ਵੇਖਦੇ ਹੈਗੇ ਵੀ ਇਤਿਹਾਸਿਕ ਰਿਕਾਰਡ ਦੇ ਵਿੱਚ ਇੰਨਾ ਤਾਰਾ ਮੰਡਲ ਸੀ ਕਿ ਬਹੁਤ ਹੀ ਜਿਆਦਾ ਹੈਗੀ ਜਿਹੜੀ ਤੁਲਨਾ ਕੀਤੀ ਗਈ ਹੈਗੀ ਆ ਐਂਡ ਵੇਖਦੇ ਹੈਗੇ ਆ ਵੱਖ ਵੱਖ ਵੀ ਮਤਲਬ ਅਲੱਗ ਅਲੱਗ ਜਿਹੜੇ ਸੱਭਿਆਚਾਰ ਹੈਗੇ ਹੈਗੇ ਉਹਦੇ ਵਿੱਚ ਇਹਨਾਂ ਨੂੰ ਕੀ ਆ ਥੋੜਾ ਵੱਖਰਾ ਦਿਖਾਇਆ ਜਾਂਦਾ ਹੈਗਾ ਠੀਕ ਹੈ ਇਹ ਵੀ ਕਲਪਨਾ ਕੀਤੀ ਜਾਂਦੀ ਹੈਗੀ ਜਿਵੇਂ ਕਈ ਸੰਨਸਕ੍ਰਿਤ ਵਾਲੇ ਹੁੰਦੇ ਹੈਗੇ ਲੋਕ ਠੀਕ ਹ ਉਹਨਾਂ ਨੇ ਤਾਰਾ ਮੰਡਲ ਨੂੰ ਦੇਖਿਆ ਹੈਗਾ ਐਜ ਅ ਸਿਗਨਸ ਐਂਡ ਕਿਲਾ ਮਤਲਬ ਉਹਨਾਂ ਨੇ ਕਿਹਾ ਜੋ ਸੰਸਕ੍ਰਿਤ ਵਾਲੇ ਲੋਕ ਸੀਗੇ ਸੱਭਿਆਚਾਰ ਦੇ ਉਨਾਂ ਨੇ ਜਿਹੜਾ ਪੋਲਰ ਬੀਅਰ ਸੀਗਾ ਇਹ ਤੋਂ ਤਾਰਾ ਮੰਡਲ ਸੀਗਾ ਉਹਨੂੰ ਐਜ ਉਹਨਾਂ ਨੇ ਪੰਛੀ ਦੇਖਿਆ ਸੀ ਐਜ ਅ ਬਰਡ ਦੇਖਿਆ ਸੀਗਾ ਇਹ ਠੀਕ ਵੀ ਹੈਗਾ ਹੈਗਾ ਬਿਕੋਜ਼ ਹਰੇਕ ਆਪਣੇ ਜਿਹੜਾ ਸੱਭਿਆਚਾਰ ਹੈਗਾ ਉਹਦੇ ਵਿੱਚ ਕੀ ਆ ਪੰਛੀ ਵੀ ਆਂਦੇ ਹੈਗੇ ਹੈਗੇ ਠੀਕ ਹੈ ਇੱਕ ਸੱਭਿਆਚਾਰ ਵੱਖਰਾ ਹੁੰਦਾ ਹੈਗਾ ਠੀਕ ਹ ਤੇ ਇਹਦੇ ਵਿੱਚ ਇੱਕ ਮਸ਼ਹੂਰ ਬਿੱਗ ਡਿੱਪਰ ਤਾਰਾਵਾਦ ਵੀ ਇਹਦੇ ਵਿੱਚ ਸ਼ਾਮਿਲ ਸੀਗਾ ਠੀਕ ਹੈ ਤੇ ਇਹਦੇ ਵਿੱਚ ਕੀ ਅਮੇਰੀਕਨਸ ਐਂਡ ਗਰੀਕ ਨੇ ਕੀ ਹੈਗਾ ਉਹਨਾਂ ਨੇ ਜਿਹੜਾ ਤਾਰਾ ਮੰਡਲ ਸੀ ਉਹਨੂੰ ਐਜ ਆ ਪੋਲਰ ਬੀਅਰ ਐਸ ਆ ਰਿਛ ਵੇਖਿਆ ਸੀਗਾ ਤੇ ਸੋ ਆਪਾਂ ਵੇਖਦੇ ਹੈਗੇ ਵੀ ਇਹ ਆਪਾਂ ਇਹ ਜਿਹੜੇ ਤਾਰਾ ਮੰਡਲ ਹੈਗੇ ਹੈਗੇ ਇਹਨਾਂ ਨੂੰ ਕਿ ਆਪਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੀ ਆ ਜਾਣ ਸਕਦੇ